ਸਾਡੇ ਇਲਾਕੇ ਵਿੱਚ ਬਿਜਲੀ ਬਹੁਤ ਜਾਂਦੀ ਹੈ ਜਿੱਥੇ ਮੈਂ ਰਹਿੰਦਾ ਆ ਰੋਜ ਬਿਜਲੀ ਇਨਾ ਪਰੇਸ਼ਾਨ ਕਰਦੀ ਏ ਤਾਂ ਤੰਗ ਆ ਕੇ ਸਾਡੇ ਘਰੇ ਨਾ ਇਨਵੇਟਰ ਛੋਟਾ ਲੱਗਿਆ ਹੋਇਆ ਸੀ ਮੈਂ ਬਿਜਲੀ ਬੋਰਡ ਦਫਤਰ ਵਾਲੇ ਨੂੰ ਫੋਨ ਕੀਤਾ ਤੇ ਮੈਨੂੰ ਜਨਰੇਟਰ ਦਾ ਬੈਕਅਪ ਚਾਹੀਦਾ ਸੀਗਾ ਇੱਕ ਵੱਡਾ ਤੇ ਇਹਨਾਂ ਦਾ ਫੋਨ ਕੀਤਾ ਉਹਨਾਂ ਨੇ ਮੈਨੂੰ ਕਈ ਸਾਰੇ ਸੁਝਾ ਦਿੱਤੇ ਕਿ ਤੁਸੀਂ ਸੋਲਰ ਪੈਨਲ ਜਾਂ ਸੋਲਰ ਸਿਸਟਮ ਜੋ ਵੀ ਅੱਜ ਕੱਲ ਨਵਾਂ ਚੱਲ ਰਿਹਾ ਤੁਸੀਂ ਉਹ ਲਗਾ ਸਕਦੇ ਹੋ ਵੱਡੀ ਬੈਟਰੀ ਵੱਡੀ ਬੈਟਰੀ ਲਗਾ ਸਕਦੇ ਹੋ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਹਦੇ ਇਹਦੇ ਖਰਚੇ ਕਿੰਨੇ ਹੋਣਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਸੋਲਰ ਦਾ ਸਿਰਫ ਲਗਵਾਣ ਦਾ ਖਰਚਾ ਹੁੰਦਾ ਆ ਬਾਕੀ ਉਹ ਜਿਹੜੀ ਸੂਰਜ ਦੀਆਂ ਕਿਰਨਾ ਪੈ ਕੇ ਤੁਹਾਨੂੰ ਇਲੈਕਟਰੀਸਿਟੀ ਦਿੰਦਾ ਆ ਪਰ ਜਿਹੜੀ ਬੈਟਰੀ ਆ ਉਹਨਾਂ ਦੀ ਖਰਚੇ ਅਲੱਗ ਅਲੱਗ ਹੁੰਦੇ ਆ ਛੋਟੀ ਦਾ ਅਲੱਗ ਵੱਡੀ ਦਾ ਅਲੱਗ ਵੱਡੀ ਦੇ ਜਿਆਦਾ ਖਰਚੇ ਹੁੰਦੇ ਨੇ ਵੱਡੀ ਦੇ ਫਿਰ ਬਿਜਲੀ ਬਿਲ ਵੀ ਆਉਂਦਾ ਆ ਪਰ ਸੋਲਰ ਸਿਸਟਮ ਵਾਲਾ ਬਿਜਲੀ ਬਿਲ ਨਹੀਂ ਆਉਂਦਾ ਕਿਉਂਕਿ ਉਹ ਸੂਰਜ ਦੀਆਂ ਕਿਰਨਾਂ ਤੋਂ ਜਿਹੜੀ ਬਿਜਲੀ ਆ ਉਹ ਪ੍ਰੋਵਾਈਡ ਕਰਦਾ ਆ ਤੇ ਆਪਾਂ ਉਹ ਵਧੀਆ ਲਗਵਾ ਸਕਦੇ ਆਂ ਤੇ ਉਹਨਾਂ ਨੇ ਮੈਨੂੰ ਇਹ ਸਜਾ ਦਿੱਤਾ ਤੇ ਮੈਂ ਬਾਕੀਆਂ ਨੂੰ ਵੀ ਦੱਸਿਆ ਕਿ ਤੁਸੀਂ ਵੀ ਇਹ ਲਗਵਾ ਸਕਦੇ ਹੋ ਤੇ ਹੁਣ ਮੈਂ ਲਗਵਾਇਆ ਹੋਇਆ ਆਪਣੇ ਘਰੇ ਵਧੀਆ ਲਾਈਟ ਆ ਰਹੀ ਹੈ ਲਾਈਟ ਕੋਈ ਪ੍ਰੋਬਲਮ ਨਹੀਂ ਹੈ ਉਹਦੇ ਨਾਲ ਵਧੀਆ